ਮੈਂ ਪਟਿਆਲੇ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਪਟਿਆਲੇ ਜ਼ਿਲ੍ਹੇ ਵਿੱਚ ਮੁੱਖ ਉਦਯੋਗ ਹਨ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਹੀ ਸੰਬੰਧਿਤ ਹਨ ਜੇਕਰ ਮੈਂ ਫੈਕਟਰੀਆਂ ਦੀ ਪਟਿਆਲੇ ਵਿੱਚ ਫੈਕਟਰੀਆਂ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ 'ਚ ਫੈਕਟਰੀਆਂ ਬਹੁਤ ਸਾਰੀਆਂ ਹਨ ਉਹਨਾਂ ਵਿੱਚੋਂ ਵੇਰਕਾ ਵੇਰਕਾ ਕਈ ਡੇਅਰੀ ਪ੍ਰੋਡਕਟਸ ਦੀ ਉਹ ਕਰਦੀ ਹੈ ਡੇਅਰੀ ਪ੍ਰੋਡਕਟਸ ਜਿਵੇਂ ਦਹੀਂ ਮੱਖਣ ਪਨੀਰ ਦੁੱਧ ਆਦਿ ਸ਼ਾਮਿਲ ਹੁੰਦੇ ਹਨ ਵੇਰਕਾ ਨੇ ਕਈ ਰੋਜ਼ਗਾ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ ਜੇਕਰ ਮੈਂ ਪਟਿਆਲੇ ਸ਼ਹਿਰ ਵਿੱਚ ਸੇਵਾ ਦੇ ਖੇਤਰ ਨਿਰਮਾਣ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤ ਹੀ ਵਧੀਆ ਤਾਂ ਆਖਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਵੇਰਕਾ ਨੇ ਬਹੁਤ ਸਾਰੇ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕੀਤਾ ਹੈ